ਸਮੇਂ ਦੇ ਨਾਲ ਪੰਜਾਬੀ ਭਾਸ਼ਾ ਕਾਫੀ ਵਿਕਸਿਤ ਹੋਈ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬੀ ਭਾਸ਼ਾ ਪੰਜਾਬ ਦੀ ਸਭ ਤੋਂ ਪ੍ਰਸਿੱਧ ਭਾਸ਼ਾ ਹੈ ਜਿਵੇਂ ਕਿ ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਭਾਸ਼ਾ ਦੀ ਰਚਨਾ ਕੀਤੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੈ ਗ੍ਰੰਥ ਸਾਹਿਬ ਜੀ ਵੀ ਪੰਜਾਬੀ ਭਾਸ਼ਾ ਵਿੱਚ ਦਿ ਪੰਜਾਬੀ ਭਾਸ਼ਾ ਵਿੱਚ ਲਿਖੇ ਗਏ ਉਹਨਾਂ ਦਾ ਇੱਕ ਇੱਕ ਅੱਖਰ ਪੰਜਾਬੀ ਭਾਸ਼ਾ ਵਿੱਚ ਵਿਕਸਿਤ ਕੀਤਾ ਗਿਆ ਬਹੁਤ ਸਾਰੀਆਂ ਬਹੁਤ ਸਾਰੇ ਦੇਸ਼ ਜਿਹੜੇ ਹੈ ਉਹ ਪੰਜਾਬੀ ਭਾਸ਼ਾ ਦਾ ਵਰਤੋਂ ਕਰਦੇ ਹਨ ਜਿਵੇਂ ਕਿ ਕਵੀ ਭਗਤ ਸਾਰੇ ਪੰਜਾਬੀ ਭਾਸ਼ਾ ਵਿੱਚ ਲਿਖਦੇ ਹਨ ਜਿਵੇਂ ਕਿ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਹਮੁਖੀ ਦਾ ਅਤੇ ਇੰਡੀਆ ਵਿੱਚ ਗੁਰਮੁਖੀ ਦਾ ਨਾਮ ਦਿੱਤਾ ਗਿਆ ਜਿਵੇਂ ਕਿ ਹਰਿਆਣੇ ਦੇ ਲੋਕ ਇਸ ਨੂੰ ਦੇਵਨਾਗਰੀ ਦੀ ਭਾਸ਼ਾ ਦੇ ਨਾਲ ਬੋਲਦੇ ਹਨ ਸਮੇਂ ਸਮੇਂ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਬਹੁਤ ਹੀ ਬ ਬਹੁਤ ਹੀ ਚੇਂਜਿਸ ਆਏ ਹਨ ਜਿਵੇਂ ਕਿ ਲੋਕ ਜ਼ਿਆਦਾਤਰ ਆਈ ਆਈਲੈਟਸ ਕਰਕੇ ਬਾਹਰ ਜਾਣ ਦੇ ਚੱਕਰਾਂ ਵਿੱਚ ਪੈ ਗਏ ਜਿਸ ਦੇ ਨਾਲ ਪੰਜਾਬੀ ਭਾਸ਼ਾ ਦਾ ਪੰਜਾਬੀ ਭਾਸ਼ਾ ਦੀ ਵਰਤੋਂ ਜਿਹੜੀ ਉਹ ਘੱਟ ਹੋ ਗਈ ਕਿਉਂਕਿ ਲੋਕ ਜ਼ਿਆਦਾ ਅੰਗਰੇਜ਼ੀ ਸਿੱਖ ਸਿੱਖ ਕੇ ਇੱਥੋਂ ਜਾਣਾ ਪਸੰਦ ਕਰਦੇ ਹਨ